ਹੈਲੋ ਹਾਂਜੀ ਐਮਾਜ਼ੋਨ ਤੋਂ ਗੱਲ ਕਰ ਰਹੇ ਜੀ ਹੈ ਨਾ ਸ਼ੂਜ ਮੰਗਵਾਏ ਸੀ ਜੀ ਰੀਬੋਕ ਦੇ ਅਤੇ ਉਹ ਬਹੁਤ ਵਧੀਆ ਨਿਕਲੇ ਅਤੇ ਕਾਫ਼ੀ ਕੰਫਰਟੇਬਲ ਹੈ ਰੇਟ ਵੀ ਬਹੁਤ ਰਿਜਨਲ ਹੈਗਾ ਅਤੇ ਮੇਰੀਆਂ ਅੱਡੀਆਂ ਦੁੱਖਦੀਆਂ ਸੀਗੀਆਂ ਉਹਦੇ ਨਾਲ ਅੱਡੀਆਂ ਵੀ ਦੁੱਖਣੋਂ ਹਟ ਗਈਆਂ ਬਹੁਤ ਹੀ ਵਧੀਆ ਸ਼ੂਜ ਹੈਗੇ ਹਾਲਾਂਕਿ ਮੈਂ ਆਪਣੇ ਦੋਸਤ ਨੂੰ ਵੀ ਰਿਕਮੈਂਡ ਕੀਤਾ ਅਤੇ ਉਹਨੇ ਵੀ ਉਸ ਤਰ੍ਹਾਂ ਦੇ ਸ਼ੂਜ ਮੰਗਵਾਏ ਮੇਰੇ ਨਾਲ ਦੇ ਬਹੁਤ ਵਧੀਆ ਕਲਰ ਵੀ ਬਹੁਤ ਅੱਛਾ ਕੱਪੜਾ ਮਾਰਦੇ ਹਾਂ ਗਿੱਲਾ ਕੱਪੜਾ ਮਾਰਦੇ ਜਦੋਂ ਬਹੁਤ ਵਧੀਆ ਨਿਕਲ ਆਉਂਦੇ ਹਨ ਰੇਟ ਵੀ ਬਹੁਤ ਘੱਟ ਹੈਗਾ ਜੇ ਹੋਰ ਕੁਆਲਿਟੀ ਨੂੰ ਦੇਖੀਏ ਤਾਂ ਬਹੁਤ ਹੀ ਰੀਜਨੇਬਲ ਰੇਟ ਹੈਗਾ ਬਹੁਤ ਹੀ ਅੱਛੇ ਕੁਆਲਿਟੀ ਦੇ ਸ਼ੂਜ ਹੈਗੇ ਆ ਮੈਂ ਅੱਗੇ ਤੋਂ ਵੀ ਇਹ ਪ੍ਰੈਫਰ ਕਰੂੰਗਾ ਕਿ ਅੱਗੇ ਤੋਂ ਵੀ ਔਨਲਾਈਨ ਹੀ ਸ਼ੂਜ ਮੰਗਾਵਾਵਾਂ ਅਤੇ ਤੁਹਾਡੀ ਡਿਲੀਵਰੀ ਬੁਆਏ ਵੀ ਬਹੁਤ ਵਧੀਆ ਸੀਗੇ ਉਹਨਾਂ ਨੇ ਕਾਫ਼ੀ ਟਾਈਮ ਪਹਿਲਾਂ ਹੀ ਮੇਰੇ ਬੂਟ ਆ ਗਏ ਸੀਗੇ ਮੈਂ ਮੈਰਿਜ 'ਤੇ ਵੀ ਪਾ ਕੇ ਗਿਆ ਉਹਨਾਂ ਨੂੰ ਕਾਫ਼ੀ ਕੰਫਰਟ ਦਿੱਤੀ ਮੈਨੂੰ ਉਹਨਾਂ ਨੇ ਪਿਛਲੇ ਸਾਲ ਮੇਰੇ ਬੂਟ ਸਮੈਲ ਜਿਹੀ ਆਉਂਦੀ ਸੀਗੀ ਉਹ ਵੀ ਨਹੀਂ ਆ ਰਹੀ ਸੀਗੀ ਬਹੁਤ ਹੀ ਚੰਗੇ ਆ ਧੰਨਵਾਦ